ਹੈਲੋ ਮੈਂ ਤੋਂ ਬਹੁਤ ਬਹੁਤ ਹੌਲੀ ਚਲਾ ਰਿਹਾ ਜੀ ਮੈਂ ਆਪਣੀ ਘੱਟ ਸਪੀਡ 'ਤੇ ਚਲਾ ਰਿਹਾ ਮੈਂ ਮਤਲਬ ਹੌਲੀ ਨਹੀਂ ਚਲਾ ਮ ਤੇਜ਼ ਨਹੀਂ ਚਲਾ ਰਿਹਾ ਤੁਹਾਡੇ ਹਿਸਾਬ ਆਪਣੇ ਹਿਸਾਬ ਨਾਲ ਚਲਾ ਰਿਹਾਂ ਠੀਕ ਚਲਾ ਰਿਹਾਂ ਮੈਡਮ ਤੁਹਾਨੂੰ ਲੱਗ ਰਿਹਾ ਮੈਂ ਮੈਂ ਬਿਲਕੁਲ ਆਪਣੇ ਹਿਸਾਬ ਨਾਲ ਚਲਾ ਰਿਹਾ ਬਿਲਕੁਲ ਸਹੀ ਚਲਾ ਰਿਹਾ ਹੌਲੀ ਚਲਾ ਰਿਹਾ ਤੁਹਾਨੂੰ ਲੱਗ ਰਿਹਾ ਇਸ ਤਰ੍ਹਾਂ ਐਸੀ ਕੋਈ ਗੱਲ ਨਹੀਂ ਹੈਗੀ ਮੈਂ ਹੌਲੀ ਚਲਾ ਰਿਹਾ ਜੀ ਅਗਰ ਇਹ ਮਹਿਸੂਸ ਹੋ ਰਿਹਾ ਐਸੀ ਕੋਈ ਗੱਲ ਨਹੀਂ ਮੈਂ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਚਲਾਉਂਦਾ ਮੈਂ ਕੋਈ ਮਤਲਬ ਜ਼ਿਆਦਾ ਤੇਜ਼ ਨਹੀਂ ਚਲਾ ਰਿਹਾ ਕਾਹਲੀ ਤਾਂ ਨਹੀਂ ਮੈਨੂੰ ਵੀ ਨਹੀਂ ਕਾਹਲੀ ਕੋਈ ਨਹੀਂ ਜਿਸ ਤਰ੍ਹਾਂ ਮੈਂ ਚਲਾ ਰਿਹਾ ਮੈਂ ਜਿਹੜੀ ਮੇਰੀ ਡਰਾਈਵਿੰਗ ਮੇਰੇ ਮੈਂ ਅੱਜ ਦੀ ਨਹੀਂ ਚਲਾ ਰਿਹਾ ਬਹੁਤ ਦੇਰ ਤੋਂ ਚਲਾ ਰਿਹਾ ਮੇਰੀ ਇਹ ਹੀ ਸਪੀਡ ਆ ਸਪੀਡ ਜ਼ਿਆਦਾ ਨਹੀਂ ਹੈਗੀ ਤੁਹਾਨੂੰ ਲੱਗ ਰਿਹਾ ਜੀ ਘਬਰਾਹਟ ਤਾਂ ਚਲੋ ਤੁਹਾਨੂੰ ਕੋਈ ਪ੍ਰੋਬਲਮ ਹੋ ਸਕਦੀ ਤੁਹਾਨੂੰ ਕੋਈ ਹੋਵੇਗੀ ਕੋਈ ਗੱਲ ਐਸੀ ਪਰ ਮੈਂ ਤਾਂ ਆਪਣੇ ਜਿਸ ਤਰ੍ਹਾਂ ਮੈਂ ਚਲਾਉਂਦਾ ਹੈ ਡੇਲੀ ਚਲਾਉਂਦਾ ਉਸ ਤਰ੍ਹਾਂ ਚਲਾ ਰਿਹਾ ਜੀ ਮੈਂ ਕੋਈ ਨਹੀਂ ਮੈਮ ਤੁਹਾਡੀ ਗੱਲ ਸਹੀ ਹੈ ਜੇ ਸਫ਼ਰ ਵੀ ਠੀਕ ਹੈ ਤਾਂ ਉਹ ਵੀ ਇਸ ਤੋਂ ਘੱਟ ਸਪੀਡ 'ਤੇ ਨਹੀਂ ਜਾਣਗੇ ਇਹੀ ਇੰਨੀ ਸਪੀਡ ਚੱਲਦੀ ਹੈ ਜੀ ਇਸ ਤੋਂ ਘੱਟ ਸਪੀਡ ਨਹੀਂ ਚਲਾ ਸਕਦੇ ਸਾਨੂੰ ਪ੍ਰੋਬਲਮ ਚਲੋ ਨਹੀਂ ਪਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਤੁਹਾਨੂੰ ਮੈਨੂੰ ਇਸ ਦੇ ਨਾਲ ਪ੍ਰੋਬਲਮ ਹੋਵੇ ਕੋਈ ਇੰਨੀ ਜ਼ਿਆਦਾ ਸਪੀਡ ਨਹੀਂ ਹੈ ਹਾਈ ਲੋਕ ਤਾਂ ਬਹੁਤ ਤੇਜ਼ ਚਲਾਉਂਦੇ ਮੈਂ ਤਾਂ ਬਹੁਤ ਸਹੀ ਚਲਾ ਰਿਹਾ ਹਾਂ ਤੁਹਾਨੂੰ ਪਤਾ ਨਹੀਂ ਕਿਉਂ ਮਹਿਸੂਸ ਹੋ ਰਿਹਾ ਇੰਨੀ ਗੱਲ ਤੇਜ਼ ਚੱਲਦੇ ਆ ਮੈਂ ਜ਼ਿਆਦਾ ਤੇਜ਼ ਨਹੀਂ ਚੱਲ ਰਿਹਾ ਮੈਮ ਮੈਂ ਬਹੁਤ ਸਹੀ ਚੱਲ ਰਿਹਾ ਹਾਂ ਮੈਡਮ ਮੈਂ ਬਿਲਕੁਲ ਮੈਂ ਸਮੂਥ ਮਤਲਬ ਸਹੀ ਚਲਾ ਰਿਹਾ ਪਤਾ ਨਹੀਂ ਤੁਹਾਨੂੰ ਕਿਉਂ ਮਹਿਸੂਸ ਹੋਇਆ ਤੁਸੀਂ ਅੱਗੇ ਕਦੀ ਬੈਠੇ ਨਹੀਂ ਕਦੀ ਜਾਂ ਫਿਰ ਸਪੀਡ ਦੇ ਵਿੱਚ ਨਹੀਂ ਬੈਠੇ ਹੋਓਗੇ ਇਸ ਕਰਕੇ ਤੁਹਾਨੂੰ

ਮੈਂ ਤਾਂ ਮੈਡਮ ਇਸ ਤੋਂ ਘੱਟ ਕੀ ਚਲਾਵਾਂਗਾ ਮੈਂ ਤਾਂ ਮਤਲਬ ਇੰਨੀ ਹੈ ਹੀ ਨਹੀਂ ਤੇਜ਼ ਹੀ ਨਹੀਂ ਹੈ ਅਤੇ ਤੁਸੀਂ ਕਿਸ ਤਰ੍ਹਾਂ ਕਹੀ ਜਾਂਦੇ ਤੇਜ਼ ਹੈ ਤੇਜ਼ ਹੈ ਮੈਂ ਤਾਂ ਬਿਲਕੁਲ ਨੋਰਮਲ ਮਤਲਬ ਬਿਲਕੁਲ ਸਹੀ ਹਲਕੀ ਹਲਕੀ ਸਪੀਡ 'ਤੇ ਜਾ ਰਿਹਾ ਤੁਹਾਨੂੰ ਪਤਾ ਕੀ ਹੋਇਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੋ ਸਕਦੀ ਕੋਈ ਹੋ ਸਕਦਾ ਕੋਈ ਦਿੱਕਤ ਕਿਉਂ ਆ ਰਹੀ ਹੈ ਤੁਹਾਨੂੰ ਇੰਨੀ ਮੈਂ ਤਾਂ ਬੜੇ ਆਰਾਮ ਨਾਲ ਚਲਾ ਰਿਹਾ ਗੱਡੀ ਟੇਡੇ ਮੇਡੇ ਤਰੀਕੇ ਨਾਲ ਤਾਂ ਨਹੀਂ ਮੈਡਮ ਮੈਂ ਤਾਂ ਬਿਲਕੁਲ ਸਿੱਧੇ ਸਿੱਧਾ ਰਸਤਾ ਵਾ ਮੈਂ ਤਾਂ ਸਿੱਧਾ ਹੀ ਜਾ ਰਿਹਾ ਮੈਂ ਕੋਈ ਟੇਡਾ ਮੇਡਾ ਨਹੀਂ ਕਿੱਥੇ ਟੇਡੇ ਮੇਡੇ ਰਸਤੇ 'ਤੇ ਜਾ ਰਿਹਾ ਬਿਲਕੁਲ ਜੋ ਰਸਤਾ ਹੈਗਾ ਉਸੇ ਰਸਤੇ 'ਤੇ ਮੈਂ ਜਾਊਂਗਾ ਮੈਂ ਕੋਈ ਇੱਧਰ ਉੱਧਰ ਕਿਉਂ ਜਾਊਂਗਾ ਇੱਦਾਂ ਟੇਡੇ ਮਡੇ ਰਸਤੇ 'ਤੇ ਜਾ ਮੈਂ ਵੀ ਤੁਹਾਨੂੰ ਨਹੀਂ ਕੁਛ ਕਹਿ ਰਿਹਾ ਮੈਂ ਵੀ ਉਹ ਹੀ ਕਹਿ ਰਿਹਾ ਮੈਂ ਬੜੇ ਆਰਾਮ ਨਾਲ ਚਲਾ ਰਿਹਾ ਹਾਂ ਤੁਹਾਨੂੰ ਮਹਿਸੂਸ ਹੁੰਦਾ ਪਿਆ ਇੱਦਾਂ ਵੀ ਤੇਜ਼ ਚੱਲ ਰਿਹਾ ਮੈਂ ਮੈਂ ਜ ਡੇਲੀ ਸਪੀਡ ਜਿਸ ਤਰ੍ਹਾਂ ਡੇਲੀ ਡੇਲੀ ਆਪਣੀ ਰਫ਼ਤਾਰ ਨਾਲ ਚੱਲਦਾ ਪਿਆ ਜਿੱਦਾਂ ਜਿੰਨੀ ਰਫ਼ਤਾਰ ਮੈਨੂੰ ਰੱਖਣੀ ਚਾਹੀਦੀ ਮੈਂ ਉਨੀਂ ਰੱਖ ਰਿਹਾ ਜੀ ਇਸ ਤਰ੍ਹਾਂ ਥੋੜ੍ਹੀ ਹੁਣ ਤੁਸੀਂ ਬੈਠੇ ਹੋ ਤਾਂ ਮੈਂ ਕਿੱਦਾਂ ਤੁਹਾਨੂੰ ਕਹਿ ਦਾਂਗਾ ਤੁਸੀਂ ਉਤਰ ਜਾਓ ਇੱਦਾਂ ਨਹੀਂ ਹੁੰਦਾ ਹੁਣ ਕਿੰਨੀ ਹੌਲੀ ਚਲਾਵਾਂ ਤੁਸੀਂ ਦੱਸ ਦਿਓ ਕਿੰਨੀ ਹੌਲੀ ਚਲਾਵਾਂ ਹੋਰ ਚਲਾ ਦੱਸ ਦਿਓ ਇਸ ਤੋਂ ਹੋਰ ਹਲਕੀ ਕਿੰਨੀ ਇੰਨੀ ਇੰਨੀ ਸਪੀ ਸਪੀਡ ਤਾਂ ਮੇਰੀ ਬਿਲਕੁਲ ਵੈਸੇ ਮੈਂ ਹੁਣ ਵਾਰ ਵਾਰ ਉਹੀ ਇੱਕੋ ਹੀ ਗੱਲ ਕਰ ਰਿਹਾ ਮੈਨੂੰ ਵੀ ਅੱਛਾ ਨਹੀਂ ਲੱਗ ਰਿਹਾ ਚੰਗਾ ਨਹੀਂ ਲੱਗ ਰਿਹਾ ਵੀ ਹਾਂ ਚਲੋ ਮੈਂ ਕੋਸ਼ਿਸ਼ ਕਰਦਾ ਕਰਨ 'ਚ ਬਾਕੀ ਚਲੋ ਜਿਹੜਾ ਇੰਨੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਦੇਖ ਲਓ ਹੋਰ ਵੀ ਕਰ ਸਕਦੇ ਤੁਸੀਂ ਹਰ ਕਰ ਸਕਦੇ ਹੋ ਸਰ ਮੈਂ ਇਸ ਤੋਂ ਕੀ ਕਰਾਂ ਕਰਦਾ ਕੋਸ਼ਿਸ਼ ਤੁਹਾਡੇ ਕਹਿਣ 'ਤੇ ਕਰ ਦਿੰਦਾ ਹੌਲੀ ਹਲਕੀ ਕਰ ਦਿੰਦਾ ਹਾਂਜੀ ਹਾਂਜੀ ਹਾਂ ਚਲੋ ਹੋਰ ਦੇਖੋ ਹੁਣ ਹੁਣ ਦੇਖੋ ਠੀਕ ਹੈ ਠੀਕ ਹੈ ਜੀ ਅੱਛਾ ਚਲੋ ਠੀਕ ਹੈ ਜੀ ਹੋਰ ਚਲੋ ਤੁਸੀਂ ਹੁਣ ਬਸ ਪਹੁੰਚਣ ਹੀ ਵਾਲੇ ਹੋ ਆਪਣੀ ਜਿੱਥੇ ਤੁਸੀਂ ਪਹੁੰਚਣਾ ਪਹੁੰਚਣ ਵਾਲੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਠੀਕ ਹੈ ਹੁਣ ਬਿਲਕੁਲ ਠੀਕ ਹੈ ਹੁਣ ਤੁਹਾਡਾ ਠੀਕ ਹੈ ਘਬਰਾਹਟ ਠੀਕ ਹੈ ਸਭਘਬਰ ਹੁਣ ਤਾਂ ਨਹੀਂ ਹੋ ਰਹੀ ਘਬਰਾਹਟ ਹਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ